ਮੇਰੀ ਫੈਮਲੀ ਦੇ ਵਿੱਚ ਮੇਰੇ ਮੰਮੀ ਪਾਪਾ ਮੇਰੇ ਬ੍ਰਦਰ ਸਿਸਟਰਜ਼ ਨੇ ਅਤੇ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਹਾਂ ਮੇਰੇ ਪਾਪਾ ਕਾਰਪੈਂਟਰ ਨੇਗੇ ਮਦਰ ਮੇਰੇ ਹਾਊਸਵਾਈਫ ਨੇ ਬ੍ਰਦਰ ਸਿਸਟਰ ਮੇਰੇ ਤੋਂ ਛੋਟੇ ਨੇਗੇ ਉਹ ਪੜ੍ਹ ਰਹੇ ਨੇ ਸਕੂਲ ਦੇ ਵਿੱਚ ਮੇਰਾ ਬ੍ਰਦਰ ਬੀ ਏ ਕਰਦਾ ਆ ਇੱਕ ਟੈਂਥ ਕਲਾਸ ਦੇ ਵਿੱਚ ਆ ਸਿਸਟਰ ਮੇਰੀ ਹਜੇ ਛੋਟੀ ਆ ਮਤਲਬ ਉਹ ਸਕੂਲ ਦੇ ਵਿੱਚ ਆ ਸਿਕਸ ਕਲਾਸ ਦੇ ਵਿੱਚ ਅਤੇ ਬਾਕੀ ਮੇਰੇ ਦੋਸਤਾਂ ਨ ਸਾਰੀਆਂ ਵਧੀਆ ਨੇ ਮੈਨੂੰ ਵਧੀਆ ਫਰੈਂਡਸ ਬਣਾਉਣੇ ਵਧੀਆ ਲੱਗਦੇ ਨੇ ਅਤੇ ਪਰ ਕੁਝ ਖਾਸ ਖਾਸ ਇਹ ਨਹੀਂ ਹੈਗਾ ਵੀ ਹਰ ਇੱਕ ਨੂੰ ਫਰੈਂਡ ਬਣਾ ਲਿਆ ਹਰ ਇੱਕ ਨਾਲ ਗੱਲਬਾਤ ਕਰ ਲਈ ਨਹੀਂ ਐਵੇਂ ਦਾ ਕੁਛ ਨਹੀਂ ਮੈਂ ਵਧੀਆ ਫਰੈਂਡ ਹੀ ਬਣਾਉਂਦੀ ਹਾਂ ਅਤੇ ਜਿਹੜੇ ਬਹੁਤ ਹੀ ਕਲੋਜ਼ ਨੇ ਮੇਰੇ ਉਹੀ ਫਰੈਂਡ ਨੇਗੇ ਹਾਲ ਤੱਕ ਮਤਲਬ ਵੀ ਹੁਣ ਮੈਂ ਇੰਨਾ ਟਾਈਮ ਹੋ ਗਿਆ ਤੇਈ ਚੌਵੀ ਸਾਲ ਹੋ ਗਏ ਸਿਰਫ ਮੇਰੇ ਪੰਜ ਸੱਤ ਫਰੈਂਡ ਨੇ ਜਿਹੜੇ ਬੈਸਟ ਨੇਗੇ ਬਹੁਤ ਵਧੀਆ ਨੇਗੇ ਇੱਕ ਮੇਰੀ ਪਲਸ ਵਨ ਪਲਸ ਟੂ ਦੀ ਫਰੈਂਡ ਆ ਇੱਕ ਮੈਨੂੰ ਸਕੂਲ ਦੇ ਵਿੱਚ ਮਿਲੀ ਸੀ ਇੱਕ ਮੈਨੂੰ ਕੋਲੇਜ ਦੇ ਵਿੱਚ ਮਿਲੀ ਸੀਗੀ ਅਤੇ ਇੱਕ ਹੁਣ ਇੱਥੇ ਮਿਲੀ ਆ ਮੈਨੂੰ ਕੰਮ ਕਰਦੇ ਟਾਈਮ ਜਦੋਂ ਮੈਂ ਇੱਥੇ ਸੀਗੀ ਓਦੋਂ ਮਿਲੇ ਸੀ ਜਦੋਂ ਮੈਂ ਇੱਕ ਕੋਰਸ ਕੀਤਾ ਸੀਗਾ ਅਸਿਸਟੈਂਟ ਮੈਨੀਫੈਕਚਰਿੰਗ ਐਂਡ ਪੈਕੇਜਿੰਗ ਦਾ ਉੱਥੇ ਮੇਰੇ ਕਲਾਸਮੇਟ ਸੀਗੇ ਜਿਹੜੇ ਉਹ ਵੀ ਮੇਰੇ ਵਧੀਆ ਫਰੈਂਡ ਬਣੇ ਸੀ ਅਤੇ ਬਾਕੀ ਮੈਨੂੰ ਕੁਛ ਖਾਸ ਖਾਸ ਹੀ ਫਰੈਂਡ ਰੱਖਣੇ ਵਧੀਆ ਲੱਗਦੇ ਨੇ ਬਾਕੀ ਮੈਂ ਆਪਣੇ ਆਲੇ ਦੁਆਲੇ ਇਨਵਾਇਰਮੈਂਟ ਆਪਣਾ ਪੋਜ਼ੀਟਿਵ ਰੱਖਦੀ ਹਾਂ ਇਸ ਲਈ ਮੈਂ ਸ ਫਰੈਂਡਸ ਆਪਣੇ ਘੱਟ ਬਣਾਉਂਦੀ ਹਾਂ ਪਰ ਜਿੰਨੇ ਵੀ ਬਣਾਉਂਦੀ ਹਾਂ ਮੈਂ ਬਹੁਤ ਵਧੀਆ ਬਣਾਉਂਦੀ ਹਾਂ